ਪਾਲਕ ਪਨੀਰ ਮਟਰ ਪਨੀਰ ਖੁੰਬਾਂ ਸਾਗ ਆਲੂ ਗੋਬੀ ਗਾਜਰ ਮਟਰ ਮੱਕੀ ਦੀ ਰੋਟੀ ਕਣਕ ਦੀ ਰੋਟੀ ਬਾਜਰੇ ਦੀ ਰੋਟੀ ਚਾਵਲ ਦੀ ਰੋਟੀ ਕੋਧਰੇ ਦੀ ਰੋਟੀ ਸ਼ਲਗਮ ਪਾਲਕ ਦੜੇਊ ਦੀ ਰੋਟੀ ਸਵਾਂਗ ਦੀ ਚਾਵਲ ਕਰੇਲੇ ਚੱਪਣ ਕੱਦੂ ਫਲੀਆਂ ਮੂੰਗਰੇ ਭਿੰਡੀ ਰਾਮਤੋਰੀ ਘੀਆ ਕੱਦੂ ਧੰਨਵਾਦ